ਹਾਂਜੀ ਬਿਲਕੁਲ ਜੀ ਅਸੀਂ ਇੱਕ ਪੇਂਡੂ ਖੇਤਰ ਦੇ ਵਿੱਚ ਸੰਗੀਤ ਉਤਸਵ ਦਾ ਆਯੋਜਨ ਕਰ ਰਹੇ ਹਾਂ ਜਿਸ ਦੇ ਵਿੱਚ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਅਤੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਸੀਂ ਨਿਰਧਾਰਿਤ ਡੇਟ ਤੋਂ ਤਕਰੀਬਨ ਕੁਛ ਦਿਨ ਪਹਿਲਾਂ ਹੀ ਜਿਹੜਾ ਕੀ ਹੈ ਪਾਣੀ ਦੇ ਪ੍ਰਬੰਧਨ ਬਾਰੇ ਆਪਣੀਆਂ ਯੋਜਨਾਵਾਂ ਸ਼ੁਰੂ ਕਰ ਦੇਵਾਂਗੇ ਠੀਕ ਹੈ ਜੀ ਉਸਦੇ ਲਈ ਸਭ ਤੋਂ ਪਹਿਲਾਂ ਅਸੀਂ ਜਿਹੜਾ ਕੀ ਹੈ ਅਥੋਰਟੀ ਨਾਲ ਜੋ ਪਾਣੀ ਪ੍ਰੋਵਾਈਡ ਕਰਵਾਉਣਗੇ ਪਾਣੀ ਨੂੰ ਨਿਰਧਾਰਿਤ ਸਮੇਂ 'ਤੇ ਪਹੁੰਚਾਉਣਗੇ ਉਨ੍ਹਾਂ ਨਾਲ ਸੰਪਰਕ ਕਰਾਂਗੇ ਠੀਕ ਹੈ ਜਲ ਅਥੋਰਟੀ ਨਾਲ ਸੰਪਰਕ ਕਰਾਂਗੇ ਉਨ੍ਹਾਂ ਨੂੰ ਆਉਣ ਵਾਲੇ ਲੋਕਾਂ ਬਾਰੇ ਜਾਣਕਾਰੀ ਦੇਵਾਂਗੇ ਕਿ ਇੰਨੀ ਜਿਹੜੀ ਕੀ ਹੈ ਲੋਕ ਆ ਰਹੇ ਹੈ ਇਸ ਕਰਕੇ ਸਾਨੂੰ ਇੰਨੀ ਗੁਣਵੱਤਾ ਦੇ ਵਿੱਚ ਪਾਣੀ ਚਾਹੀਦਾ ਹੈ ਤਾਂ ਉਹ ਗੁਣਵੱਤਾ ਲੋਕਾਂ ਦੇ ਅਧਾਰ 'ਤੇ ਜੇਕਰ ਇੱਕ ਟੈਂਕਰ ਨਾਲ ਪੂਰੀ ਹੁੰਦੀ ਹੈ ਤਾਂ ਉਹ ਟੈਂਕਰ ਬਾਰੇ ਉਨ੍ਹਾਂ ਤੋਂ ਜਿਹੜਾ ਕੀ ਹੈ ਬੇਨਤੀ ਕਰਾਂਗੇ ਉਨ੍ਹਾਂ ਨੂੰ ਕਿ ਸਾਨੂੰ ਇਸ ਡੇਟ ਨੂੰ ਜਿਹੜਾ ਕੀ ਹੈ ਟੈਂਕਰ ਪਹੁੰਚਾਉਣ ਦੀ ਕ੍ਰਿਪਾਲਤਾ ਕਰੋ ਲੇਕਿਨ ਫਿਰ ਵੀ ਜੇਕਰ ਆਦਮੀਆਂ ਦੀ ਗਿਣਤੀ ਵਧਦੀ ਹੈ ਔਰ ਪਾਣੀ ਦਾ ਇੱਕ ਟੈਂਕਰ ਘੱਟ ਪੈਂਦਾ ਹੈ ਤਾਂ ਅਸੀਂ ਜਿਹੜਾ ਕੀ ਹੈ ਉਨ੍ਹਾਂ ਕੋਲ ਦੋ ਟੈਂਕਰਾਂ ਦੀ ਮੰਗ ਕਰਾਂਗੇ ਇਸ ਤੋਂ ਇਲਾਵਾ ਹੀ ਜਿਹੜੇ ਕਿ ਖ਼ਾਸ ਖ਼ਾਸ ਹਸਤੀਆਂ ਜਿਹੜੀਆਂ ਪਹੁੰਚਣਗੀਆਂ ਉਨ੍ਹਾਂ ਲਈ ਪਾਣੀ ਦੇ ਟੈਂਕਰ ਤੋਂ ਇਲਾਵਾ ਬੋਤਲਾਂ ਵਾਲਾ ਪਾਣੀ ਵੀ ਪ੍ਰੋਵਾਈਡ ਕਰਵਾਵਾਂਗੇ ਉਨ੍ਹਾਂ ਦੇ ਪੀਣ ਲਈ ਛੋਟੀਆਂ ਬੋਤਲਾਂ ਵੀ ਜਿਹੜੀਆਂ ਕੀ ਮੁਹੱਈਆ ਕਰਵਾਵਾਂਗੇ ਇਸ ਕਰਕੇ ਸਮੇਂ 'ਤੇ ਜਿਹੜਾ ਕੀ ਹੈ ਪਾਣੀ ਦੀ ਕੋਈ ਕਮੀ ਨਾ ਰਹੇ ਇਸ ਤੋਂ ਇਲਾਵਾ ਅਸੀਂ ਮੌਸਮ ਦਾ ਧਿਆਨ ਵੀ ਲਵਾਂਗੇ ਜੇਕਰ ਉਹ ਮੰਨ ਲਓ ਕਿਹੜੇ ਮੌਸਮ ਦੇ ਵਿੱਚ ਸਮਾਗਮ ਹੋ ਰਿਹਾ ਹੈ ਉਤਸਵ ਹੋ ਰਿਹਾ ਹੈ ਸੰਗੀਤਕ ਉਤਸਵ ਅਸੀਂ ਉਹਦੇ ਲਈ ਜਿਹੜਾ ਕੀ ਹੈ ਜੇਕਰ ਉਹ ਗਰਮੀ ਚ ਹੋ ਰਿਹਾ ਤਾਂ ਅਸੀਂ ਉਹ ਪਾਣੀ ਨੂੰ ਠੰਡਾ ਕਰਨ ਦੀ ਵੀ ਜ਼ਰੂਰਤ ਹੈ ਠੀਕ ਹੈ ਪਾਣੀ ਨੂੰ ਜਿਹੜਾ ਕੋਲਡ ਕਰਨ ਦੀ ਜ਼ਰੂਰਤ ਹੈ ਜੇਕਰ ਉਹ ਸਰਦੀ ਦੇ ਵਿੱਚ ਹੋ ਰਿਹਾ ਤਾਂ ਨੋਰਮਲ ਪਾਣੀ ਕਿਵੇਂ ਪ੍ਰੋਵਾਈਡ ਕਰਵਾਉਣਾ ਹੈ ਉਹਦਾ ਵੀ ਪ੍ਰਬੰਧ ਕਰਨਾ ਪਵੇਗਾ ਸਾਨੂੰ ਤਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਪਾਣੀ ਦੀ ਸਮੱਸਿਆ ਦੇ ਨਾਲ ਕਿਵੇਂ ਨਜਿੱਠਣਾ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਰੱਖ ਕੇ ਪੂਰਾ ਬੰਦਿਆਂ ਦੀ ਡਿਊਟੀ ਲਗਾਈ ਜਾਵੇਗੀ ਵਲੰਟੀਅਰਸ ਦੀ ਡਿਊਟੀ ਲਗਾਈ ਜਾਵੇਗੀ ਕਿ ਕੋਈ ਪਾਣੀ ਵੱਲੋਂ ਜਿਹੜਾ ਕੀ ਹੈ ਕਿਸੇ ਵੀ ਆਦਮੀ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਤਾਂ ਇਹ ਸਾਰੀਆਂ ਗੱਲਾਂ ਦਾ ਧਿਆਨ ਜਿਹੜਾ ਕੀ ਹੈ ਉਸ ਸਮਾਗਮ ਦੇ ਵਿੱਚ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਵੀ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪਹਿਲਾਂ ਵੀ ਸਮਾਗਮ ਕਰਵਾਏ ਹੋਏ ਹੈ ਉਨ੍ਹਾਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਵੇਗਾ ਕਿ ਤੁਸੀਂ ਜਿਹੜਾ ਕੀ ਹੈ ਕਿਸ ਤਰ੍ਹਾਂ ਕੀਤਾ ਸੀ ਕਿੰਨੇ ਇੰਨੇ ਲੋਕਾਂ ਲਈ ਕਿੰਨਾ ਪਾਣੀ ਚਾਹੀਦਾ ਸੀ ਪਾਣੀ ਦੀ ਕਮੀ ਤਾਂ ਨਹੀਂ ਪਈ ਸੀ ਜਾਂ ਪਾਣੀ ਨੂੰ ਮੌਕੇ 'ਤੇ ਤਾਂ ਨਹੀਂ ਮੰਗਵਾਉਣਾ ਪਿਆ ਦੁਬਾਰਾ ਲੋਕਾਂ ਦਾ ਪਾਣੀ ਪੀਣਾ ਮਤਲਬ ਇਸ ਤਰ੍ਹਾਂ ਦਾ ਕੋਈ ਬੁਰਾ ਹਾਲ ਤਾਂ ਨਹੀਂ ਹੋਇਆ ਇਸ ਕਰਕੇ ਜਿੰਨੀ ਵੀ ਅਸੀਂ ਲੋਕਾਂ ਨੂੰ ਜਿਹੜਾ ਕੀ ਹੈ ਜੀ ਆਇਆਂ ਆਖਿਆ ਹੈ ਜਾਂ ਜਿਨ੍ਹਾਂ ਨੂੰ ਬੁਲਾਇਆ ਹੈ ਉਨ੍ਹਾਂ ਦੇ ਹਿਸਾਬ 'ਤੇ ਪਾਣੀ ਦਾ ਕੰਮ ਤਾਂ ਕੁਛ ਦਿਨ ਪਹਿਲਾਂ ਹੀ ਸ਼ੁਰੂ ਕਰ ਲਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਸਮਾਗਮ ਵਾਲੇ ਦਿਨ ਕਿਸੇ ਵੀ ਕਿਸਮ ਦੀ ਪਾਣੀ ਨਾਲ ਸਬੰਧਿਤ ਕੋਈ ਵੀ ਕਿੱਲਤ ਨਾ ਆਵੇ ਸਾਰਾ ਸਮਾਗਮ ਵਧੀਆ ਤਰੀਕੇ ਦੇ ਨਾਲ ਸਿਰੇ ਚੜ੍ਹੇ ਇਸ ਕਰਕੇ ਜਿਹੜਾ ਕੀ ਹੈ ਪਾਣੀ ਦੀ ਤਾਂ ਪਹਿਲੀ ਮੰਗ ਹੁੰਦੀ ਹੈ ਜਾਂ ਪਾਣੀ ਸਾਡੇ ਜੀਵਨ ਦਾ ਪਹਿਲਾ ਸਰੋਤ ਹੁੰਦਾ ਇਸ ਕਰਕੇ ਅਸੀਂ ਖਾਣੇ ਨੂੰ ਥੋੜ੍ਹਾ ਬਹੁਤ ਟਾਲ ਮਟੋਲ ਕਰ ਸਕਦੇ ਹਾਂ ਲੇਟ ਕਰ ਸਕਦੇ ਹਾਂ ਲੇਕਿਨ ਪਾਣੀ ਜਦੋਂ ਚਾਹੀਦਾ ਉਦੋਂ ਚਾਹੀਦਾ ਹੀ ਹੈ ਇਸ ਕਰਕੇ ਇਹ ਸਾਰੀਆਂ ਕਿਸੇ ਵੀ ਸਮਾਗਮ ਨੂੰ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਤਾਂ ਇਹਦਾ ਅਸੀਂ ਬੜੇ ਧਿਆਨਪੂਰਵਕ ਤਰੀਕੇ ਦੇ ਨਾਲ ਇਹਦਾ ਹੱਲ ਕਰਾਂਗੇ